ਪੰਜਾਬ ਵਿੱਚ ਟੈਕਨੋਲੋਜੀ ਸੈਕਟਰ ਉੱਭਰ ਰਹੀਆਂ ਟੈਕਨੋਲਜੀਆਂ ਜਾਂ ਰੁਝਾਨਾਂ ਦਾ ਲਾਭ ਲੈ ਸਕਦੇ ਹਾਂ ਜਿਸ ਦੇ ਵਿੱਚ ਅਸੀਂ ਨਕਲੀ ਬੁੱਧੀ ਜਿਹਨੂੰ ਕਿ ਰਬੋਟਿਕ ਪ੍ਰੋਸੈਸ ਕਹਿੰਦੇ ਹਾਂ ਇੰਟਰਨੈਟ ਚੀਜ਼ਾਂ ਦਾ ਇੰਟਰਨੈਟ ਵਲੋਗ ਚੇਨ ਫਾਈਵ ਜੀ ਜਿਹਨੂੰ ਕਿ ਐਜ ਕੰਪਿਊਟਿੰਗ ਕਹਿੰਦੇ ਹਾਂ ਉਸ ਦੀ ਵਰਤੋਂ ਕਰਕੇ ਕਰ ਸਕਦੇ ਹਾਂ ਜਿਵੇਂ ਕਿ ਟੈਕਨੋਲਜੀ ਸੈਕਟਰ ਦੇ ਵਿੱਚ ਉੱਭਰ ਰਹੀਆਂ ਗਤੀਵਿਧੀਆਂ ਅਸੀਂ ਕੰਪਿਊਟਿੰਗ ਰਬੋਟਿਕ ਕਮਿਊਟਿੰਗ ਨਾਲ ਕਰ ਸਕਦੇ ਹਾਂ ਜਿਸ ਦੇ ਵਿੱਚ ਅਸੀਂ ਕੋਈ ਵੀ ਚੀਜ਼ ਨੂੰ ਦੀ ਗਣਨਾ ਕਰਨ ਲਈ ਕੰਪਿਊਟਰ ਦੀ ਵਰਤੋਂ ਕਰਦੇ ਹਾਂ ਜਿਵੇਂ ਕਿ ਆਊਟਪੁੱਟ ਲਿਆਉਣ ਲਈ ਉਹਦੀ ਵਰਤੋਂ ਕਰਦੇ ਹਾਂ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਹਨ ਜਿਵੇਂ ਕਿ ਅੱਜ ਦੀ ਤੁਹਾਨੂੰ ਪਤਾ ਹੀ ਹੈ ਅੱਜ ਦੀ ਟੈਕਨੋਲੋਜੀ ਬਹੁਤ ਹੀ ਐਡਵਾਂਸ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਵੀ ਇਹ ਬਹੁਤ ਹੀ ਅੱਗੇ ਵੱਡੇ ਪੱਧਰ 'ਤੇ ਵੱਧ ਚੁੱਕੀ ਹੈ ਜਿਸ ਦੇ ਨਾਲ ਆਪਾਂ ਇੰਟਰਨੈਟ ਦੀ ਵਰਤੋਂ ਕਰਕੇ ਜਿਹਦੇ ਵਿੱਚ ਕੀ ਹੁਣ ਤੁਹਾਨੂੰ ਪਤਾ ਹੀ ਹੈ ਫਾਈਵ ਜੀ ਨੈਟ ਵੀ ਆ ਚੁੱਕਿਆ ਹੈ ਉਹਦੀ ਵਰਤੋਂ ਕਰਕੇ ਵੀ ਆਪਾਂ ਅੱਗੇ ਵੱਧ ਸਕਦੇ ਹਾਂ ਆਪਣੀ ਟੈਕਨੋਲਜੀ ਸੈਕਟਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਕੇ ਅੱਗੇ ਵੱਧ ਸਕਦੇ ਹਾਂ ਜਿਹਦੇ ਵਿੱਚ ਕਿ ਆਪਾਂ ਨੂੰ ਹਰ ਇੱਕ ਚੀਜ਼ ਦੇ ਵਿੱਚ ਅੱਗੇ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸਦੇ ਵਿੱਚ ਇੰਟਰਨੈਟ ਸਭ ਤੋਂ ਵਧੀਆ ਤਰੀਕਾ ਹੈ ਇਸਦਾ